ਹੈਲੋ ਸਤਿ ਸ਼੍ਰੀ ਅਕਾਲ ਮੈਂ ਨਾ ਗੁਰਦਾਸਪੁਰ ਤੋਂ ਬੋਲਦੇ ਪਈ ਹਾਂ ਸ਼ੰਤੋਸ਼ ਕੁਮਾਰੀ ਮੈਂ ਨਾ ਕਿਸੇ ਦੇ ਕੱਪੜੇ ਸਿੱਤੇ ਸੀ ਉਹਨਾਂ ਨੂੰ ਹੱਥ ਨਾਲ ਸੀ ਕੇ ਉਹਨੂੰ ਗਿਫਟ ਦਿੱਤਾ ਸੀ ਉਹਨਾਂ ਨੇ ਉਹਨਾਂ ਨੂੰ ਬਹੁਤ ਵਧੀਆ ਲੱਗਾ ਮੈਂ ਇਸ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕਿ ਜੋ ਮੈਂ ਆਪਣੇ ਹੱਥ ਨਾਲ ਬਣਾ ਕੇ ਕਿਸੇ ਨੂੰ ਤੋਹਫਾ ਦਿੱਤਾ ਸੀ ਉਹ ਉਹਨੂੰ ਬਹੁਤ ਵਧੀਆ ਲੱਗਿਆ ਉਹਨਾਂ ਦੀ ਤਰੀਫ ਉਹਨਾਂ ਨੇ ਤਾਂ ਬਹੁਤ ਕੀਤੀ ਪਰ ਜਿਹਨਾਂ ਨੇ ਉਹਨਾਂ ਨੂੰ ਉਹ ਕੱਪੜਾ ਪਾਏ ਦਾ ਦੇਖਿਆ ਸੀ ਉਹਨਾਂ ਨੇ ਇਸ ਵੀ ਉਸ ਦੀ ਤਾਰੀਫ ਬਹੁਤ ਜ਼ਿਆਦਾ ਕੀਤੀ ਕਿ ਇਹ ਬਹੁਤ ਵਧੀਆ ਬਣਿਆ ਹੋਇਆ ਏ ਜਿਹਨੇ ਵੀ ਆ ਕੱਪੜਾ ਹੱਥ ਨਾਲ ਬਣਾਇਆ ਆ ਉਹਨੂੰ ਕਾਫੀ ਹੁਨਰ ਕੱਪੜਾ ਬਣਾਉਣ ਬਾਰੇ ਇਸ ਲਈ ਇਹ ਸਾਨੂੰ ਇਹੀ ਕਰਨਾ ਚਾਹੀਦਾ ਕਿ ਜੋ ਵੀ ਅਸੀਂ ਕੰਮ ਕਰਦੇ ਹਾਂ ਕੋਈ ਵੀ ਆਪਾਂ ਹੱਥ ਨਾਲ ਕੋਈ ਚੀਜ਼ ਬਣਾਉਂਦੇ ਹਾਂ ਕੱਪੜਾ ਬਣਾਉਦੇ ਆ ਉਸਨੂੰ ਕਾਫੀ ਆਪਣਾ ਮੰਨ ਲਾ ਕੇ ਉਸਨੂੰ ਪੂਰਾ ਕਰੋ ਤਾਂ ਕਿ ਜੋ ਵੀ ਉਸਨੂੰ ਪਾਏ ਉਹ ਹੈ ਦੇਖਦਾ ਹੀ ਰਹਿ ਜੇ ਕਿ ਇਹ ਬਹੁਤ ਵਧੀਆ ਚੀਜ਼ ਬਣੀ ਹੈ ਉਸਦੀ ਤਾਰੀਫ ਕਰੋ ਜਦੋਂ ਕੋਈ ਇਸ ਦੀ ਤਰੀਫ ਕਰਦਾ ਹੈ ਤਾਂ ਸਾਨੂੰ ਬਹੁਤ ਵਧੀਆ ਲੱਗਦਾ ਹੈ ਕਿ ਉਹ ਸਾਡੀ ਤਾਰੀਫ ਕਰ ਰਿਹਾ ਕਿ ਇਸਨੇ ਇੰਨੀ ਵਧੀਆ ਚੀਜ਼ ਬਣਾਈ ਇੰਨਾ ਵਧੀਆ ਕੱਪੜਾ ਸੀਤਾ ਇਸ ਨਾਲ ਸਾਡੀ ਤਾਂ ਇੱਜ਼ਤ ਵਧਦੀ ਹੈ ਲੇਕਿਨ ਜਿਹਨੇ ਸਾਨੂੰ ਇਹ ਕੰਮ ਸਿਖਾਇਆ ਹੁੰਦਾ ਵਾ ਉਹਦੀ ਵੀ ਬਹੁਤ ਤਾਰੀਫ ਕੀਤੀ ਜਾਂਦੀ ਹੈ ਕਿ ਹਾਂ ਕਿ ਇਸਨੂੰ ਬਹੁਤ ਵਧੀਆ ਤਰੀਕੇ ਨਾਲ ਜਿਹਨੇ ਵੀ ਸਮਝਾਇਆ ਸਿਖਾਇਆ ਵਾ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਵਾ ਇਸ ਲਈ ਸਾਨੂੰ ਕੋਈ ਵੀ ਕੰਮ ਕਰਨ ਲੱਗਿਆ ਆਪਣਾ ਪੂਰੀ ਪ੍ਰੀਤ ਨਾਲ ਇਹ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਜੋ ਇਸ ਕੱਪੜੇ ਨੂੰ ਕੋਈ ਵੀ ਪਾਉਂਦਾ ਹੈ ਅਤੇ ਉਹ ਉਹਨੂੰ ਵਧੀਆ ਲੱਗੇ ਪਾਉਣ ਵਾਲੇ ਨੂੰ ਵੀ ਵਧੀਆ ਲੱਗੇ ਅਤੇ ਜੋ ਇਸ ਨੂੰ ਦੇਖਦਾ ਹੈ ਉਸਨੂੰ ਵੀ ਵਧੀਆ ਲੱਗੇ ਠੀਕ ਆ ਇਸ ਲਈ ਸਾਨੂੰ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਕਿ ਇਹ ਸਾਡੀ ਤਰੀਫ ਦੇ ਲਾਈਕ ਹੋਏ ਤਾਂ ਕਿ ਵਧੀਆ ਬਣੇ ਇਸ ਲਈ ਕੋਈ ਵੀ ਇਸ ਬਾਰੇ ਤਾਰੀਫ ਕਰੇ ਕਿ ਹਾਂ ਵੀ ਇਹ ਇਹਨੇ ਬਹੁਤ ਵਧੀਆ ਬਣਾਇਆ ਹੈ ਕਿ ਸਾਨੂੰ ਵੀ ਇਹ ਬਣਾ ਕੇ ਦੋ ਤੁਸੀਂ ਠੀਕ ਆ ਇਸ ਲਈ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ